ਹੈਲੋ ਹਾਂਜੀ ਐਮਾਜੋਨ ਸਹਾਇਤਾ ਕੇਂਦਰ ਤੋਂ ਬੋਲ ਰਹੇ ਹੋ ਹਾਂਜੀ ਹਾਂਜੀ ਹਾਂਜੀ ਵੀਰ ਜੀ ਮੈਂ ਇੱਕ ਵਾਇਲੈਂਸ ਹੈਡਫੋਨ ਤੇ ਜੋੜੀ ਆਨਲਾਈਨ ਆਰਡਰ ਕੀਤੀ ਸੀ ਹਾਂਜੀ ਵੀਹ ਮਾਰਚ ਨੂੰ ਆਰਡਰ ਕੀਤੀ ਆ ਹਾਂਜੀ ਹਾਂਜੀ ਇਹਦੇ ਪੈਸੇ ਦੇ ਚੁੱਕੀ ਹ ਮੈਂ ਪਰ ਇਹਦੀ ਅਦਾਇਗੀ ਬਾਰੇ ਕੁਝ ਵੀ ਸਪਸ਼ਟ ਨਹੀਂ ਹੋ ਰਿਹਾ ਸਾਈਡ ਦੇ ਉੱਤੇ ਹਾਂਜੀ ਚੈੱਕ ਕੀਤਾ ਜੀ ਹਾਂਜੀ ਇਹ ਪ੍ਰੋਡਕਟ ਸੀਗਾ ਜੀ ਸੈਮਸੰਗ ਦਾ ਹੈਡਫੋਨ ਹੈ ਕਾਲੇ ਰੰਗ ਦਾ ਹਾਂਜੀ ਇਹਦੀ ਅਦਾਇਗੀ ਜਿਹੜੀ ਸੀ ਤੇਈ ਮਾਰਚ ਦੀ ਦੱਸੀ ਗਈ ਸੀ ਪਰ ਹੁਣ ਇਹ ਕਿੱਥੇ ਪਹੁੰਚਿਆ ਇਹਦੇ ਬਾਰੇ ਚ ਕੁਝ ਵੀ ਸਪਸ਼ਟ ਨਹੀਂ ਹੋ ਰਿਹਾ ਹਾਂਜੀ ਮੇਰਾ ਆਰਡਰ ਨੰਬਰ ਨੋਟ ਕਰੋ ਤਿੰਨ ਚਾਰ ਛੇ ਪੰਜ ਸੱਤ ਅੱਠ ਨੌ ਹਾਂਜੀ ਹਾਂਜੀ ਬਿਲਕੁਲ ਸਹੀ ਸੀ ਹਾਜੀ ਕਿਰਪਾ ਕਰਕੇ ਤੁਸੀਂ ਮੇਰੀ ਸ਼ਿਕਾਇਤ ਨੋਟ ਕਰ ਲਓ ਤਾਂ ਜੋ ਜਲਦੀ ਤੋਂ ਜਲਦੀ ਮੈਨੂੰ ਹੈਡਫੋਨ ਹੈ ਹਾਂਜੀ ਬਹੁਤ ਜਰੂਰੀ ਹੈ ਠੀਕ ਹ ਜੀ ਸ਼ਿਕਾਇਤ ਨੰਬਰ ਨੋਟ ਕਰ ਲਿਤਾ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ